ਹੈਲੋ ਹੈਲੋ ਸਰ ਤੁਸੀਂ ਸਵੀਗੀ ਤੋਂ ਬੋਲਦੇ ਪਏ ਜੇ ਸਰ ਮੈਂ ਤੁਹਾਡੇ ਨਾਲ ਇੱਕ ਕੰਪਲੇਂਟ ਕਰਨੀ ਚਾਹੁੰਦੀ ਹਾਂ ਸਰ ਸਾਡੇ ਨਾ ਇੱਥੋਂ ਮੈਂ ਪਾਰਸਲ ਮੰਗਵਾਇਆ ਸੀ ਤੁਹਾਡੇ ਕੋਲੋਂ ਅਤੇ ਉਹ ਡਿਲੀਵਰੀ ਬੁਆਏ ਜਿਹੜਾ ਆਇਆ ਸੀ ਉਹਨੇ ਮੇਰੇ ਨਾਲ ਬਹੁਤ ਗੰਦਾ ਬਿਹੇਵੀਅਰ ਕੀਤਾ ਬਹੁਤ ਅਸ਼ਲੀਲ ਹਰਕਤ ਕੀਤੀ ਉਹਨੇ ਮੇਰਾ ਹੱਥ ਫੜ ਲਿਆ ਜਿਹਦੇ ਕਰਕੇ ਮੈਂ ਤੁਹਾਨੂੰ ਸ਼ਿਕਾਇਤ ਕਰਨਾ ਚਾਹੁੰਦੀ ਹਾਂ ਕਿ ਇਸ ਬੁਆਏ ਡਿਲੀਵਰੀ ਬੁਆਏ ਦੇ ਖਿਲਾਫ਼ ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇ ਕਿਉਂਕਿ ਇਹ ਹਰਕਤਾਂ ਬਿਲਕੁਲ ਹੀ ਚੰਗੀਆਂ ਨਹੀਂ ਹੈਗੀਆਂ ਕਿਉਂਕਿ ਇਹ ਤੁਹਾਡੇ ਡਿਲੀਵਰੀ ਜਿੱਦਾਂ ਤੁਹਾਡਾ ਕੰਮ ਕਾਰੋਬਾਰ ਦੇ ਉੱਤੇ ਵੀ ਬਹੁਤ ਹੀ ਇਫੈਕਟ ਪੈਂਦਾ ਵਾ ਅਤੇ ਇਹ ਚੀਜ਼ਾਂ ਨਹੀਂ ਚਾਹੀਦੀਆਂ ਅਤੇ ਤੁਸੀਂ ਕਦੋਂ ਇਸ ਚੀਜ਼ ਬਾਰੇ ਕਾਰਵਾਈ ਕਰੋਂਗੇ ਤੁਸੀਂ ਮੈਨੂੰ ਦੱਸੋ ਔਰ ਇਹਦੇ ਪ੍ਰਤੀ ਜ਼ਰੂਰ ਕੋਈ ਨਾ ਕੋਈ ਤੁਹਾਨੂੰ ਕਦਮ ਚੁੱਕਣਾ ਚਾਹੀਦਾ ਵਾ ਕਿਉਂਕਿ ਇਹ ਅੱਜ ਮੇਰੇ ਨਾਲ ਹੋਇਆ ਕੱਲ੍ਹ ਹੋਰ ਕਿਸੇ ਨਾਲ ਵੀ ਹੋ ਸਕਦੀ ਆ ਤੁਹਾਨੂੰ ਜ਼ਰੂਰ ਚਾਹੀਦਾ ਵਾਂ ਇਹ 'ਤੇ ਕਾਰਵਾਈ ਕਰਨੀ